ਪੰਜਾਬ ਦੀ ਮੁੱਖ ਭਾਸ਼ਾਵਾਂ ਦੀ ਗੱਲ ਕਰੀਏ ਤਾਂ ਪੰਜਾਬੀ ਮੇਨ ਜਿਹੜੀ ਭਾਸ਼ਾ ਇਹ ਬੋਲੀ ਜਾਂਦੀ ਆਂ ਪਰ ਉਹ ਖੇਤਰੀ ਜਿਹੜੀ ਹੈਗੀ ਆ ਵਿਭਿੰਨਤਾ ਦੇ ਬੇਸ 'ਤੇ ਜਿਹੜੀ ਹੈਗੀ ਅਸੀਂ ਅੱਡ ਅੱਡ ਕੀਤੀ ਹੋਈ ਆ ਜਿਵੇਂ ਪੁਆਧੀ ਦੁਆਬੀ ਮਾਝੀ ਜਿਹੜੇ ਹੈਗੇ ਨੇ ਇਹ ਇਲਾਕੇ ਜਿਹੜੇ ਅੱਡ ਅੱਡ ਆਪਣੀ ਲਿਖਤੀ ਭਾਸ਼ਾ ਉਹਨਾਂ ਦੀ ਹੋਰ ਹੈ ਲਿਖਤੀ ਪੰਜਾਬੀ ਹੋਈ ਹੈ ਪਰ ਉਹਨੂੰ ਬੋਲਣ ਦਾ ਤਰੀਕਾ ਜਿਹੜਾ ਅੱਡ ਅੱਡ ਹੈ ਇਹ ਵਿਭ ਵਿਭਿੰਨਤਾ ਦਰਸਾਉਂਦੀ ਹੈ ਜਿਹੜੀ ਪੁਆਧੀ ਭਾਸ਼ਾ ਹੈ ਪੁਆਧ ਵਾਲੀ ਦੇ ਵਿੱਚ ਥੋੜ੍ਹੇ ਜਿਹੇ ਹਿੰਦੀ ਦੇ ਸ਼ਬਦ ਵੀ ਆਉਂਦੇ ਨੇ ਅਤੇ ਜਿਹੜੀ ਮਲਵਈ ਭਾਸ਼ਾ ਹੈ ਮਲਵਈ ਇਲਾਕੇ ਦੇ ਲੋਕ ਨੇ ਉਹ ਬੋਲਦੇ ਨੇ ਉਹ ਹੈ ਪੰਜਾਬੀ ਉਹ ਲਿਖਤੀ ਰੂਪ ਵਾਲੇ ਪੰਜਾਬੀ ਬੋਲਦੇ ਨੇ ਜੇ ਅਸੀਂ ਅੰਬਰਸਰੀ ਦੀ ਗੱਲ ਕਰੀਏ ਅੰਬਰਸਰੀ ਲੋਕ ਨੇ ਜਿਹੜੇ ਉਹਨਾਂ ਦੇ ਵਿੱਚ ਵਾਧੂ ਸ਼ਬਦ ਆਉਂਦੇ ਨੇ ਹੋਰ ਕਈ ਜਿਹੜੀਆਂ ਐਦਾਂ ਦੀਆਂ ਵਿਭਿੰਨਤਾ ਜਿਹੜੇ ਪੰਜਾਬ ਦੇ ਵਿੱਚ ਬੇਸ਼ੱਕ ਪੰਜਾਬੀ ਓ ਬੋਲੀ ਮੇਨ ਹੈ ਮੁੱਖ ਭਾਸ਼ਾ ਦੇ ਤੌਰ 'ਤੇ ਬੋਲੀ ਜਾਂਦੀ ਹੈ ਪਰ ਜਿਹੜੀ ਉਹਨਾਂ ਦੀ ਬੋਲੀ ਅਤੇ ਲਿਖਤੀ ਰੂਪ ਉਹ ਅੱਡ ਅੱਡ ਹੋਣ ਕਰਕੇ ਉਹ ਵਿਭਿੰਨਤਾਵਾਂ ਦੇ ਵਿੱਚ ਅਤੇ ਉਹ ਰਾਜ ਦੇ ਵਿਭਿੰਨ ਸੱਭਿਆਚਾਰ ਪ੍ਰ ਪ੍ਰਭਾਵਾਂ ਨੂੰ ਦਰਸਾਉਣ ਦੇ ਲਈ ਕੀ ਆ ਅੱਡ ਅੱਡ ਪੰਜਾਬੀ ਭਾਸ਼ਾਵਾਂ ਦੇ ਨਾਲ ਜਿਹੜੇ ਕੰਮ ਕਰਵਾਏ ਜਾਂਦੇ ਨੇ ਸੋਸਾਇਟੀਆਂ ਬਣੀਆ ਹੋਈਆਂ ਨੇ ਅਤੇ ਜਿਹੜੇ ਉਹਨਾਂ ਦੇ ਗਾਣੇ ਜਾਂ ਉਹਨਾਂ ਦੇ ਜਿਹੜੇ ਲੋਕ ਨਾਚ ਨੇ ਉਹ ਸੇਮ ਨੇ ਉਹ ਜਿਹੜੀ ਹੈਗੀ ਆਪਣੀ ਪੰਜਾਬੀ ਓ ਰਹਿਣੀ ਹੈ ਉਹਨਾਂ ਦੀ ਮੇਨ ਭਾਸ਼ਾ